ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਮਾਨ ਸਿੰਘ ਤੁਸੀਂ ਪਾਲ ਸਿੰਘ ਬੋਲਦੇ ਹੋ ਅਸੀਂ ਮੇਰੇ ਇਹ ਨੰਬਰ ਮੇਰੇ ਬ੍ਰਦਰ ਨੇ ਦਿੱਤਾ ਸੀ ਅਸੀਂ ਟੈਕਸੀ ਬਾਰੇ ਪੁੱਛਣਾ ਹੈ ਅਸੀਂ ਮੈਂ ਅਤੇ ਮੇਰੀ ਫੈਮਿਲੀ ਘੁੰਮਣ ਜਾਣਾ ਚਾਹੁੰਦੇ ਹੋ ਕੀ ਤੁਹਾਡੀ ਟੈਕਸੀ ਫਰੀ ਹਨ ਜੇਕਰ ਤੁਹਾਡੀ ਟੈਕਸੀ ਫਰੀ ਹੈ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਕਿਉਂ ਅਤੇ ਤੁਹਾਡੀ ਟੈਕਸੀ ਦਾ ਕੀ ਪ੍ਰਾਈਸ ਹੈ ਅਸੀਂ ਸ਼ਿਮਲੇ ਕਨੀ ਘੁੰਮਣ ਜਾਣਾ ਹੈ ਹਫਤੇ ਦੀਆਂ ਛੁੱਟੀਆਂ ਹਫ਼ਤੇ ਦੇ ਲਈ ਜੇਕਰ ਤੁਸੀਂ ਸਾਡੀ ਆਪਣੀ ਟੈਕਸੀ ਭੇ ਆਪਣੀ ਟੈਕਸੀ ਭੇਜ ਸਕਦੇ ਹੋ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗੇ ਅਤੇ ਮੈਂ ਤੁਹਾਨੂੰ ਆਪਣਾ ਐਡਰੈੱਸ ਵੀ ਦੇ ਦੇਵਾਂਗਾ ਥੈਂਕ ਯੂ ਧੰਨਵਾਦ